ਅਸੀਂ ਰੋਜ਼ਾਨਾ ਦੇ ਆਧਾਰ 'ਤੇ ਸ਼ੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਕਿਵੇਂ ਫੇਸਬੁਕ ਟਵੀਟਰ ਸਨੈਪਚੈਟ ਵਟਸਐਪ ਗੁਗਲ ਮੀਟ ਆਦਿ ਦੀ ਵਰਤੋਂ ਕਰਦੇ ਹਾਂ ਉਹਨਾਂ ਨੇ ਸਾਡੇ ਵਿਸ਼ਵ ਦ੍ਰਿਸ਼ਟੀਕੌਣ ਨੂੰ ਅਦਾ ਆਕਾਰ ਦੇਣ ਵਿੱਚ ਸਾਡੀ ਬੋਤ ਮਦਦ ਕੀਤੀ ਹੈ ਜਿਵੇਂ ਅਸੀਂ ਫੇਸਬੁਕ ਦੇ ਜਰੀਏ ਇੱਕ ਦੂਜੇ ਨੂੰ ਕੁਨੈਕਟ ਕਰ ਸਕਦੇ ਹਾਂ ਇੱਕ ਦੂਜੇ ਨਾਲ ਫਰੈਂਡ ਫੈਮਲੀ ਰਿਲੇਸ਼ਨ ਵੀ ਬਣਾ ਸਕਦੇ ਹਾਂ ਅਸੀਂ ਦੂਰ ਹੁੰਦੇ ਹੋਏ ਵੀ ਉਹਨਾਂ ਦੇ ਨੇੜੇ ਹੋ ਜਾਂਦੇ ਹਾਂ ਫੇਸਬੁਕ ਨੇ ਸਾਨੂੰ ਸੋਸ਼ਲ ਮੀਡੀਆ ਤੋਂ ਵੀ ਬਹੁਤ ਹੀ ਵਧੀਆ ਇਨਫੋਰਮੇਸ਼ਨ ਦਿੰਦੇ ਹਨ ਅਸੀਂ ਵਧੀਆ ਵਧੀਆ ਕੋਈ ਥੋਟ ਲੈ ਲੈਂਦੇ ਹਾਂ ਕੋਈ ਐਕਸਪੀਰੀਐਂਸ ਲੈਨ ਲੈਂਦੇ ਹਾਂ ਬਹੁਤ ਵਧੀਆ ਇਨਫੋਮੇਸ਼ਨ ਮਿਲਦੀਆਂ ਹਨ ਅਸੀਂ ਆਪਣੇ ਡਿਵੈਲਪਿੰਗ ਸਕਿਲ ਨੂੰ ਵੀ ਬੜਾ ਹੀ ਕਮਨੀਕੇਟ ਕਰਕੇ ਕਰ ਸਕਦੇ ਹਾਂ ਇਹਦੇ ਵਿੱਚ ਵੀ ਬੱਚੇ ਆਪਣੇ ਨੈਟਵਰਕਿੰਗ ਸਕਿਲ ਨੂੰ ਪਰਸਨਲ ਬ੍ਰੈਂਡ ਲਾ ਕੇ ਅਤੇ ਉਹਨਾਂ ਨੂੰ ਹੈਲਪ ਮਿਲ ਜਾਂਦੀ ਹੈ ਅਸੀਂ ਆਪਦੀ ਪ੍ਰੋਫੈਸ਼ਨਲ ਡਿਵੈਲਪਮੈਂਟ ਵੀ ਕਰ ਸਕਦੇ ਹਾਂ ਉਹਦੇ ਵਿੱਚ ਜਿਵੇਂ ਇੱਕ ਦੂਜੇ ਨੂੰ ਕੋਈ ਡਿਜ਼ਾਇਨ ਸ਼ੇਪ ਜਾਂ ਕੋਈ ਪ੍ਰੋਫੈਸ਼ਨਲ ਆਡੈਂਟੀਜ਼ ਦੇਣੀਆਂ ਹਨ ਕੋਈ ਫੀਡਬੈਕ ਇੱਕ ਦੂਜੇ ਨੂੰ ਪ੍ਰਾਪਤ ਕਰਵਾਉਣਾ ਹੈ ਕਿਸੇ ਨੂੰ ਆਪਾਂ ਸਪੋਰਟ ਵੀ ਕਰ ਸਕਦੇ ਹਾਂ ਆਪਾਂ ਨੂੰ ਸਿਵਿਕ ਸੋਸ਼ਲ ਮੀਡੀਆ ਦੇ ਜਰੀਏ ਉਹਦੀ ਵੀ ਆਪਾਂ ਨੂੰ ਸੋਸ਼ਲ ਅਵੇਰਨੈਸ ਮਿਲ ਜਾਂਦੀ ਹੈ ਆਪਾਂ ਮਾਰਕੀਟਿੰਗ ਵੀ ਕਰ ਲੈਂਦੇ ਹਾਂ ਉਹਦੇ ਨਾਲ ਆਪਾਂ ਨੂੰ ਪ੍ਰਮੋਸ਼ਨਲ ਟੂਲਸ ਵੀ ਮਿਲ ਜਾਂਦੇ ਹਨ ਸ਼ੋਸ਼ਲ ਮੀਡੀਆ ਦੇ ਜਰੀਏ ਆਪਾਂ ਨੂੰ ਬਹੁਤ ਸਾਰੀਆਂ ਓਪਰਚੁਨੀ ਟੀਜ਼ ਮਿਲਦੀਆਂ ਹਨ ਇਸ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਅੱਗੇ ਲੈ ਜਾਂਦੇ ਹਾਂ ਆਪਾਂ ਨੂੰ ਕੋਈ ਐਂਟਰਟੇਨਮੈਂਟ ਕਰਨਾ ਹੋਵੇ ਉਹ ਵੀ ਆਪਾਂ ਸ਼ੋਸ਼ਲ ਮੀਡੀਆ ਨਾਲ ਚਲੇ ਜਾਦੇ ਹਾਂ ਆਪਾਂ ਕਿਸੇ ਨੂੰ ਵੈਬਸਾਈਟ 'ਤੇ ਟਰੈਫਿਕ ਦੇ ਜਰੀਏ ਵੀ ਆਪਾਂ ਨੂੰ ਮਿਲ ਜਾਂਦੇ ਹਾਂ ਆਪਾਂ ਨੂੰ ਭੂਗੋਲਿਕ ਦੂਰੀਆਂ ਕਿਸੇ ਦੇ ਦੋਸਤ ਪਰਿਵਾਰ ਵਿਅਕਤੀ ਕਿਸੇ ਨਾਲ ਜੁੜਨਾ ਹੋਵੇ ਉਹ ਵੀ ਆਪਾਂ ਨੂੰ ਮਿਲ ਜਾਂਦਾ ਹੈ ਆਪਾਂ ਇੱਕ ਕਿਸੇ ਰਿਸ਼ਤਿਆਂ ਨਾਲ ਵੀ ਰਿਸ਼ਤੇ ਕਨੈਕਟੀਵਿਟੀ ਕਰ ਲੈਂਦੇ ਹਾਂ ਜਿਹੜੇ ਆਤਮ ਸਨਮਾਨ ਹੈ ਸਮਰਥਨ ਹੈ ਆਪਣਾ ਅਤੇ ਆਪਣੀ ਭਾਵਨਾ ਨੂੰ ਵੀ ਵੜਾਵਾ ਦੇ ਸਕਦੇ ਹਾਂ ਆਪਾਂ ਇੱਕ ਦੂਜੇ ਨਾਲ ਨਿਕਟ ਸਮੁਦਾਇ ਦੀ ਭਾਵਨਾ ਨੂੰ ਵੀ ਵੜਾਵਾ ਦੇ ਸਕਦੇ ਹਾਂ ਆਪਾਂ ਨੇ ਇਸ ਕਰਕੇ ਸਮੇਂ ਵੀ ਬਚਦਾ ਹੈ ਦੂਰੀ ਦੇ ਕਾਰਨ ਆਪਣੇ ਰਿਸ਼ਤੇ ਵੀ ਨਹੀਂ ਫਿੱਕੇ ਪੈਂਦੇ ਆਪਾਂ ਨੂੰ ਸੋਸ਼ਲ ਮੀਡੀਆ ਨੇ ਬਹੁਤ ਪਿਆਰ ਵੀ ਦਿੱਤਾ ਹੈ ਆਪਾਂ ਆਪਦੇ ਦੋਸਤਾਂ ਨਾਲ ਵੀਡੀਓ ਕਾਲਿੰਗ ਕਰਕੇ ਗੱਲਬਾਤ ਕਰ ਲੈਦੇ ਹਾਂ ਇਸ ਨਾਲ ਆਪਣੀ ਜ਼ਿੰਦਗੀ ਬਹੁਤ ਆਸਾਨ ਹੋ ਜਾਂਦੀ ਹੈ ਕਈ ਬਜ਼ੁਰਗ ਲੋਕ ਨੇ ਉਹ ਆਪਣੇ ਪੁਰਾਣੇ ਪੁਰਾਣੇ ਦੋਸਤਾਂ ਨਾਲ ਆਪਣੇ ਗੁੰਮੇ ਹੋਏ ਦੋਸਤਾਂ ਨਾਲ ਫਿਰ ਤੋਂ ਰਿਸ਼ਤੇ ਬਣਾ ਲੈਂਦੇ ਹਨ ਆਪਾਂ ਨੂੰ ਉਹ ਬਹੁਤ ਹੀ ਅਟਰੈਕਟਿਵ ਕਰਦੇ ਹਨ ਆਪਾਂ ਤਾਂ ਬਹੁਤ ਹੀ ਸੌਖੇ ਹੋ ਗਏ ਹਾਂ ਆਪਾਂ ਨੂੰ ਸੋਸ਼ਲ ਮੀਡੀਆ ਨੇ ਬਹੁਤ ਹੀ ਕੁਛ ਦਿੱਤਾ ਹੈ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਟਵਿੱਟਰ ਦੇ ਜਰੀਏ ਵੀ ਆਪਾਂ ਮਿਲ ਲੈਂਦੇ ਹਾਂ ਆਪਾਂ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਵੀ ਸਾਂਝੇ ਕਰ ਲੈਂਦੇ ਹਾਂ ਫੇਸਬੁਕ ਹੈ ਟਵੀਟਰ ਹੈ ਆਪਾਂ ਤਾਂ ਬਹੁਤ ਕੁਛ ਚਲੇ ਜਾਂਦੇ ਹਾਂ ਆਪਾਂ ਨੂੰ ਇਹਨਾਂ ਨੇ ਬਹੁਤ ਹੀ ਸੌਖਾ ਬਣਾ ਦਿੱਤਾ ਹੈ ਆਪਾਂ ਨੂੰ ਇਹਨਾਂ ਦੇ ਜਿਹੜੇ ਲੋਕ ਸੰਪਰਕ ਵਿੱਚ ਰਹਿੰਦੇ ਹਨ ਗੱਲਬਾਤ ਕਰਦੇ ਹਨ ਉਹਨਾਂ ਦੇ ਦੁੱਖ ਸੁੱਖ ਵੀ ਪਤਾ ਲੱਗ ਜਾਂਦੇ ਹਨ ਆਪਾਂ ਤਾਂ ਇਹਨਾਂ ਨੂੰ ਬਹੁਤ ਹੀ ਕਰਕੇ ਸੌਖਾ ਬਣ ਗਏ ਹਾਂ ਆਪਾਂ ਨੂੰ ਤਾਂ ਕੋਈ ਆਪਾਂ ਕੋਈ ਬਿਲਡਿੰਗ ਬਣਾਉਣੀ ਹੈ ਉਹਨਾਂ ਦੇ ਡਿਜ਼ਾਇਨ ਮਿਲਗੇ ਕੋਈ ਆਪਾਂ ਕਿਸੇ ਔਡੀਅੰਸ ਨੂੰ ਆਪਣੀ ਸੋਸ਼ਲ ਮੀਡੀਆ ਦੇ ਜਰੀਏ ਕੋਈ ਮਾਰਕੀਟਿੰਗ ਕਰਨੀ ਹੈ ਉਹ ਆਪਾਂ ਨੂੰ ਮਿਲ ਗਿਆ ਆਪਾਂ ਇਹਨਾਂ ਦੇ ਜਰੀਏ ਬਿਜ਼ਨਸ ਵਿੱਚ ਗਰੋਥ ਬਹੁਤ ਕਰ ਲੈਂਦੇ ਹਾਂ ਆਪਾਂ ਕਸਟਮਰ ਵੀ ਬਣਾ ਲੈਂਦੇ ਹਾਂ ਅਤੇ ਉਹਨਾਂ ਨੂੰ ਸੈਟਿਸਫਾਈਡ ਵੀ ਕਰ ਲੈਂਦੇ ਹਾਂ ਆਪਾਂ ਨੂੰ ਐਜੂਕੇਸ਼ਨ ਦੇ ਜਰੀਏ ਵੀ ਆਪਾਂ ਨੂੰ ਪੜ੍ਹਾਈ ਦੇ ਜਰੀਏ ਵੀ ਇਹਨਾਂ ਦੇ ਆਨਲਾਈਨ ਕਲਾਸਾਂ ਵੀ ਲੱਗ ਜਾਂਦੀਆਂ ਹਨ ਆਪਾਂ ਆਪਣੀ ਕੋਈ ਕੌਮਨੀਕੇਸ਼ਨ ਹੈ ਕੋਈ ਆਪਾਂ ਆਪਣੀ ਇਨਫੋਰਮੇਸ਼ਨ ਹੈ ਉਹਨੂੰ ਵੀ ਆਪਾਂ ਇਮਪਰੂਵ ਕਰ ਲੈਂਦੇ ਹਾਂ ਜਿਹੜੇ ਲੋਕ ਫਰੀ ਹਨ ਬੇਰੁਜ਼ਗਾਰ ਹਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਮਿਲ ਜਾਂਦੀ ਹੈ ਕਿ ਉਹਨਾਂ ਨੂੰ ਆਨਲਾਈਨ ਘਰ ਬੈਠੇ ਕੰਮ ਕਰ ਲੈਂਦੇ ਹਨ ਆਪਾਂ ਇੱਕ ਦੂਜੇ ਨੂੰ ਐਂਟਰਟੇਨ ਵੀ ਕਰ ਲੈਂਦੇ ਹਾਂ ਸੋਸ਼ਲ ਮੀਡੀਆ ਦੇ ਜਰੀਏ ਆਪਾਂ ਆਪਣੇ ਆਪ ਨੂੰ ਬਹੁਤ ਹੀ ਸੌਖਾ ਕਰ ਲਿਆ ਹੈ ਆਪਾਂ ਤਾਂ ਸੋਸ਼ਲ ਮੀਡੀਆ ਦੇ ਜਰੀਏ ਇੱਕ ਦੂਜੇ ਨੂੰ ਕੋਈ ਆਪਾਂ ਬਿਲਡਿੰਗ ਬਣਾਉਣੀ ਉਹਦੇ ਜਰੀਏ ਵੀ ਉਹਦੀ ਹੈਲਪ ਕਰ ਲੈਂਦੇ ਹਾਂ ਇਸ ਕਰਕੇ ਸਾਨੂੰ ਸੋਸ਼ਲ ਮੀਡੀਆ ਨੇ ਬਹੁਤ ਹੀ ਵੱਡਾ ਪਲੇਟਫਾਰਮ ਦਿੱਤਾ ਹੈ ਅਸੀਂ ਤਾਂ ਬਹੁਤ ਸੌਖੇ ਹੋ ਗਏ ਹਾਂ ਇਹਦੀ ਐਡਵਾਂਟੇਜ ਤਾਂ ਬਹੁਤ ਜ਼ਿਆਦਾ ਨੇ ਅਤੇ ਡਿਸਐਡਵਾਂਟੇਜ ਬਹੁਤ ਘੱਟ ਨੇ ਬਸ ਇੰਨਾ ਹੈ ਕਿ ਆਪਾਂ ਇਸ ਨਾਲ ਘੱਟ ਤੋਂ ਘੱਟ ਵਰਤੋਂ ਕਰੀਏ ਕਿ ਆਪਾਂ ਆਪਣੇ ਆਪ ਨੂੰ ਸੌਖੇ ਬਣਾ ਲਵਾਂਗੇ